ਮੈਂ ਯੂਟਿਊਬ 'ਤੇ ਬਹੁਤ ਸਾਰੇ ਚੈਨਲਸ ਵਗੈਰਾ ਦੇਖਦੀ ਹਾਂ ਅਤੇ ਮੈਨੂੰ ਸਾਂਝੀ ਰਸੋਈ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਇਸ ਵਿੱਚ ਉਹ ਬਹੁਤ ਆਸਾਨ ਅਤੇ ਬਹੁਤ ਵਧੀਆ ਖਾਣਾ ਬਣਾਉਣਾ ਸਿਖਾਉਂਦੇ ਹਨ ਅਤੇ ਇਸ ਵਿੱਚ ਮੈਂ ਕਈ ਤਰ੍ਹਾਂ ਦੀਆਂ ਪਕਵਾਨ ਬਣਾਉਣੇ ਸਿੱਖੇ ਹਨ ਜਿਵੇਂ ਕਿ ਕੜਾਹੀ ਪੀ ਪਨੀਰ ਸ਼ਾਹੀ ਪਨੀਰ ਅਤੇ ਚਾਈਨੀਸ ਡਿਸ਼ੀਜ਼ ਵੀ ਜਿਵੇਂ ਕਿ ਨਿਊਡਲਸ ਵਗੈਰਾ ਆਦਿ ਅਤੇ ਮੈਂ ਟੀਵੀ ਤੋਂ ਤੋਂ ਜਿਵ ਮਾਸਟਰ ਸ਼ੈਫ ਦੇਖ ਕੇ ਬਹੁਤ ਤਰ੍ਹਾਂ ਦੇ ਵਿਅੰਜਨ ਬਣਾਉਣੇ ਸਿੱਖੇ ਹਨ ਅਤੇ ਇਹ ਬਹੁਤ ਆਸਾਨ ਦਿਖਾਉਂਦੇ ਹਨ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਸਾਰੇ ਮੇਰੀ ਬਹੁਤ ਤਾਰੀਫ਼ ਕਰਦੇ ਹਨ